ਸ਼ਿਲਪਕਾਰੀ ਪੁਰਾਣੇ ਸਮਿਆਂ ਤੋਂ ਹੀ ਚੱਲਦੀ ਆ ਰਹੀ ਹੈ ਇਹ ਇੱਕ ਤਰ੍ਹਾਂ ਦਾ ਆਰਟ ਹੈ ਸ਼ਿਲਪਕਾਰੀ ਪੰਜਾਬੀ ਕੋਸ਼ ਅਨੁਸਾਰ ਸ਼ੈਲਪ ਤੋਂ ਭਾਵ ਕਾਰੀਗਰੀ ਹੁਨਰ ਤੋਂ ਲਿਆ ਜਾਂਦਾ ਹੈ ਖੂਬਸੂਰਤੀ ਲੋੜ ਮਿਹਨਤ ਅਤੇ ਕਾਰੀਗਰੀ ਦੀ ਮੁਹਾਰਤ ਇਸ ਦੇ ਪ੍ਰਮੁੱਖ ਤੱਤ ਹਨ ਲੋਕ ਸ਼ਿਲਪਕਾਰੀ ਦਾ ਘੇਰਾ ਬਹੁਤ ਵੱਡਾ ਅਤੇ ਪੁਰਾਣਾ ਹੈ ਪੁਰਾਣੀਆਂ ਮੂਰਤਾਂ ਪੱਥਰ ਮੋਹਰਾਂ ਇਸ ਦਾ ਸਬੂਤ ਦਿੰਦੀਆਂ ਹਨ ਪੁਰਾਣੇ ਸਮੇਂ ਵਿੱਚ ਮੂਲ ਰੂਪ ਵਿੱਚ ਇਹਨਾਂ ਦੀਆਂ ਦੋ ਸ਼੍ਰੇਣੀਆਂ ਬਣਾਈਆਂ ਜਾਂਦੀਆਂ ਸਨ ਪਹਿਲੀ ਮਰਦਾਂ ਦੁਆਰਾ ਸ਼ਿਲਪਕਾਰੀ ਕੀਤੀ ਜਾਂਦੀ ਸੀ ਜਿਸ ਵਿੱਚ ਟੋਕਰੇ ਛਿੱਕੂ ਛੱਜ